ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਮਹੱਤਤਾ ਹੈ ਭੰਗੜਾ ਪੰਜਾਬ ਦੇ ਉੱਘੇ ਅਤੇ ਪ੍ਰਸਿੱਧ ਲੋਕ ਨਾਚਾਂ ਵਿੱਚੋਂ ਇੱਕ ਹੈ ਇਸ ਤੋਂ ਇਲਾਵਾ ਇੱਕ ਪ੍ਰਸਿੱਧ ਲੋਕ ਨਾਚ ਗਿੱਧਾ ਵੀ ਹੈ ਭੰਗੜਾ ਗੱਭਰੂਆਂ ਦੁਆਰਾ ਪਾਇਆ ਜਾਣ ਵਾਲ਼ਾ ਨਾਚ ਹੈ ਅਤੇ ਗਿੱਧਾ ਮੁਟਿਆਰਾਂ ਦੁਆਰਾ ਪਾਇਆ ਜਾਂਦਾ ਹੈ ਭੰਗੜਾ ਸਮੇਂ ਦੇ ਨਾਲ਼ ਪੰਜਾਬ ਦੇ ਤਿਓਹਾਰਾਂ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ ਭੰਗੜਾ ਪੰਜਾਬ ਦੇ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪੁਰਾਣਾ ਹੈ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਜਾਣ ਵਾਲ਼ਾ ਨਾਚ ਹੈ ਜਿਵੇਂ ਕਿ ਤਿਓਹਾਰਾਂ ਵਿੱਚ ਵੀ ਲੋਗ ਭੰਗੜਾ ਪਾ ਕੇ ਖੁਸ਼ੀਆਂ ਮਨੋਦੇ ਹਨ ਕਿ ਕਣਕ ਦੀ ਵਾਢੀ ਭਾਵ ਵਿਸਾਖੀ ਵਿੱਚ ਵੀ ਕਿਸਾਨ ਭੰਗੜਾ ਪਾ ਕੇ ਜਸ਼ਨ ਮਨੋਦੇ ਹਨ ਭੰਗੜਾ ਇੱਕ ਬਹੁਤ ਹੀ ਇਤਿਹਾਸਿਕ ਨਾਚ ਹੈ ਭੰਗੜੇ ਵਿੱਚ ਪੇਂਡੂ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਢੋਲ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਭੰਗੜਾ ਇੱਕ ਬਹੁਤ ਹੀ ਮਹੱਤਵਪੂਰਨ ਨਾਚ ਹੈ ਭੰਗੜੇ ਵਿੱਚ ਢੋਲੀ ਦੀ ਬਹੁਤ ਹੀ ਮਹੱਤਤਾ ਹੁੰਦੀ ਹੈ ਢੋਲੀ ਤਾਲ ਉੱਤੇ ਢੋਲ ਵਜਾਉਂਦਾ ਹੈ ਅਤੇ ਲੋਗ ਉਸ ਦੇ ਆਲ਼ੇ ਦੁਆਲ਼ੇ ਚੱਕਰ ਬਣਾ ਕੇ ਨੱਚਦੇ ਹਨ